ਨਿੱਕੇ ਹੁੰਦੇ ਇੱਕ ਵਾਰ ਮੇਰੀ ਮਾਤਾ ਜੀ ਨੂੰ ਬਹੁਤ ਹੀ ਜ਼ਰੂਰੀ ਕੰਮ ਪੈ ਗਿਆ ਅਤੇ ਉਹਨਾਂ ਨੂੰ ਜਾਣਾ ਪਿਆ ਪਿੱਛੋਂ ਮੇਰੇ ਲਈ ਭੋਜਨ ਪਕਾਉਣ ਵਾਲਾ ਕੋਈ ਨਹੀਂ ਸੀ ਪਰ ਮੈਨੂੰ ਬਹੁਤ ਹੀ ਤੇਜ਼ ਭੁੱਖ ਲੱਗ ਰਹੀ ਸੀ ਇਸ ਲਈ ਮੈਂ ਸੋਚਿਆ ਕਿ ਮੈਂ ਖੁਦ ਹੀ ਖਾਣਾ ਪਕਾਵਾਂਗਾ ਅਤੇ ਮੈਂ ਖਾਣਾ ਪਕਾਉਣ ਲਈ ਰਸੋਈ ਵਿੱਚ ਚਲਾ ਗਿਆ ਪਰ ਮੈਨੂੰ ਖਾਣਾ ਪਕਾਉਣਾ ਬਿਲਕੁਲ ਵੀ ਨਹੀਂ ਆਉਂਦਾ ਸੀ ਤਾਂ ਮੈਂ ਆਪਣਾ ਮੋਬਾਈਲ ਕੱਢਿਆ ਅਤੇ ਇੰਟਰਨੈਟ ਤੋਂ ਖਾਣਾ ਬਣਾਉਣਾ ਸਿੱਖਣਾ ਸ਼ੁਰੂ ਕੀਤਾ ਮੈਂ ਉੱਥੇ ਬਹੁਤ ਸਾਰੀ ਸਬਜ਼ੀਆਂ ਦੀ ਰੈਸਪੀ ਦੇਖੀ ਅਤੇ ਫਿਰ ਮੈਂ ਆਲੂ ਬਣਾਉਣ ਦੀ ਰੈਸਪੀ ਦੇਖੀ ਜੋ ਕਿ ਮੈਨੂੰ ਥੋੜ੍ਹੀ ਸੌਖੀ ਲੱਗੀ ਤਾਂ ਮੈਂ ਇੰਟਰਨੈਟ ਤੋਂ ਦੇਖ ਦੇਖ ਕੇ ਉਹ ਬਣਾਉਣੇ ਸ਼ੁਰੂ ਕਰ ਦਿੱਤੇ ਨਾਲ ਹੀ ਮੈਂ ਆਪਣੇ ਭੂਆ ਜੀ ਨੂੰ ਫੋਨ ਕਰਕੇ ਵੀ ਉਸ ਬਾਰੇ ਪੁੱਛਦਾ ਗਿਆ ਅਤੇ ਉਹਨਾਂ ਦੀ ਸਲਾਹ ਲੈ ਲੈ ਕੇ ਵੀ ਖਾਣਾ ਅੱਗੇ ਬਣਾਉਂਦਾ ਗਿਆ ਜਿਸ ਨਾਲ ਖਾਣਾ ਬਹੁਤ ਹੀ ਸਵਾਦ ਬਣਿਆ ਅਤੇ ਮੈਨੂੰ ਪਹਿਲੀ ਵਾਰ ਖਾਣਾ ਬਣਾਉਣ ਵਿੱਚ ਬਹੁਤ ਹੀ ਜ਼ਿਆਦਾ ਮਜ਼ਾ ਵੀ ਆਇਆ